ਪੰਦਰ੍ਹਾਂ ਇੱਕ ਸੌ ਸਤਾਰ੍ਹਾਂ ਇੱਕ ਹਜ਼ਾਰ ਦੋ ਸੌ ਪਚਾਨਵੇਂ ਦਸ ਹਜ਼ਾਰ ਛੇ ਸੌ ਇਕਾਨਵੇਂ ਇੱਕ ਲੱਖ ਪੰਜ ਹਜ਼ਾਰ ਸੱਤ ਸੌ ਪਚਾਸੀ